ਬਿਜਲੀ ਸਾਡੀ ਜ਼ਿੰਦਗੀ ਦਾ ਇੱਕ ਜ਼ਰੂਰੀ ਹਿੱਸਾ ਹੈ ਜੇ ਇੱਕ ਦਿਨ ਬਿਜਲੀ ਨਹੀਂ ਆਉਂਦੀ ਤਾਂ ਆਪਾਂ ਦੇਖ ਹੀ ਸਕਦੇ ਹਾਂ ਵੀ ਆਪਣਾ ਕੀ ਹਾਲ ਹੋ ਜਾਂਦਾ ਬਟ ਜਿੱਥੇ ਵੀ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਹਨ ਜਿਵੇਂ ਕੋਈ ਚੀਜ਼ ਦੇ ਕੋਈ ਲਾਭ ਹਨ ਉਸ ਤਰ੍ਹਾਂ ਹੀ ਉਹਦੇ ਕੁਛ ਨਾ ਕੁਛ ਮਤਲਬ ਨੁਕਸਾਨ ਵੀ ਹੋ ਸਕਦੇ ਹਨ ਅਤੇ ਬਿਜਲੀ ਵੀ ਇੱਕ ਖਤਰਨਾਕ ਚੀਜ਼ ਹੈ ਜੇ ਆਪਾਂ ਇਸਨੂੰ ਧਿਆਨ ਦੇ ਨਾਲ ਨਾ ਵਰਤੋਂ ਵਿੱਚ ਲਿਆਈਏ ਹੈ ਨਾ ਜੇ ਤੁਸੀਂ ਵੀ ਕੋਈ ਵੀ ਬਿਜਲੀ ਦਾ ਯੰਤਰ ਯੂਜ ਕਰ ਰਹੇ ਹੋ ਤਾਂ ਤੁਸੀਂ ਆਪਣਾ ਧਿਆਨ ਰੱਖਣਾ ਹੈ ਕਿ ਤੁਸੀਂ ਪੈਰ ਦੇ ਵਿੱਚ ਜਿਹੜੀ ਹੈਗੀ ਆ ਉਹ ਜੁੱਤੀ ਜ਼ਰੂਰ ਪਾਈ ਹੋਵੇ ਤਾਂ ਕਿ ਤੁਸੀਂ ਜਿਹੜੀ ਬਿਜਲੀ ਆ ਉਹ ਕਰੰਟ ਲੱਗ ਸਕਦਾ ਹੈ ਤੁਹਾਨੂੰ ਬਿਜਲੀ ਦਾ ਕੋਈ ਵੀ ਯੰਤਰ ਯੂਜ ਕਰਦੇ ਹੋਏ ਤਾਂ ਇਸ ਕਰਕੇ ਕਦੇ ਵੀ ਗਿੱਲੇ ਹੱਥਾਂ ਨਾਲ ਬਿਜਲੀ ਦੇ ਕਿਸੇ ਵੀ ਯੰਤਰ ਨੂੰ ਤੁਸੀਂ ਜਿਹੜਾ ਹੈਗਾ ਨਹੀਂ ਟੱਚ ਕਰਨਾ ਹੈਗਾ ਅਤੇ ਕਿਤੇ ਵੀ ਨੰਗੀ ਤਾਰ ਹੋਵੇ ਤਾਂ ਉਸਨੂੰ ਸੈਲੋ ਟੇਪ ਦੇ ਨਾਲ ਤੁਸੀਂ ਢਕਣਾ ਹੈ ਠੀਕ ਹੈ ਉਹਨਾਂ ਨੂੰ ਵੀ ਤੁਸੀਂ ਨਹੀਂ ਹੱਥ ਲਗਾਉਣਾ ਹੈਗਾ ਜਿਵੇਂ ਹੁਣ ਵਾਸ਼ਿੰਗ ਮਸ਼ੀਨ ਕਈ ਵਾਰ ਆਪਾਂ ਯੂਜ ਕਰਦੇ ਹਾਂ ਕਈ ਵਾਰ ਕੀ ਹੁੰਦਾ ਕਿ ਚੱਲਦੀ ਚੱਲਦੀ ਵਾਸ਼ਿੰਗ ਮਸ਼ੀਨ ਨੂੰ ਹੀ ਆਪਾਂ ਟੱਚ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹ ਵੀ ਤੁਸੀਂ ਨਹੀਂ ਕਰਨੀ ਹੈਗੀ ਅਤੇ ਇਹਨਾਂ ਧਿਆਨ ਜ਼ਰੂਰ ਰੱਖਣਾ ਹੈ ਕਿ ਤੁਸੀਂ ਆਪਣੇ ਪੈਰ ਦੇ ਵਿੱਚ ਹਮੇਸ਼ਾ ਜੁੱਤੀ ਪਾ ਕੇ ਰੱਖਣੀ ਹੈ ਅਤੇ ਆਪਣੇ ਗਿੱਲੇ ਹੱਥ ਜਿਹੜੇ ਹੈਗੇ ਆ ਉਹ ਕਿਸੇ ਯੰਤਰ ਨੂੰ ਨਹੀਂ ਲਗਾਉਣੇ ਹੈਗੇ ਸੁੱਕੇ ਹੱਥ ਹੀ ਹਮੇਸ਼ਾ ਲਗਾਉਣੇ ਹੈ